ਕਿਦਾ ਦੇ ਪਲਾ ਜੀ ਕਿਦਾ ਦੇ ਚਾਹੀਦੇ ਜੀ

ਅੱਛਾ ਜੀ ਅੱਛਾ ਜੀ ਅੱਛਾ ਜੀ

ਕੂਕਰ ਵਧੀਆ ਸਟਾਰਟਿੰਗ ਹੋਵੇ ਸਾਢੇ ਕੁ ਪੰਜ ਸੌ ਤੋਂ ਸਟਾਰਟ ਹੋ ਜਾਂਦੇ ਨੇ ਜੀ ਉੱਪਰ ਵਧੀਆ ਤਿੰਨ ਹਜ਼ਾਰ ਪੈਂਤੀ ਸੌ ਤੱਕ ਵੀ ਪਏ ਨੇ ਬਾਕੀ ਤੁਹਾਡੇ ਲੈਣ ਦੇ ਉੱਪਰ ਡਿਪੈਂਡ ਆ ਤੁਸੀਂ ਕਿੱਦਾ ਦੇ ਲੈਣੇ ਜੀ ਵਧੀਆ ਹੈਵੀ ਥੋੜਾ ਜਿਹਾ ਕੋਈ ਡਿਜਾਇਨਿੰਗ ਵਗੈਰਾ ਬਾਕੀ ਮਿਕਸ ਵਗੈਰਾ ਰੱਖੇ ਹੋਏ ਨਾਲ ਜਾ ਰਹੇ ਆ ਨਹੀ ਨਾਨ ਸਟਿਕ ਨੀ ਸਟੀਲ ਦੇ ਨੇ ਜੀ

ਬਾਕੀ ਮਿਕਸੀ ਮਿਕਸਰ ਵਗੈਰਾ ਨਾਲ ਆਨਲਾਈਨ ਵੀ ਹੁੰਦੀ ਹੈ ਪੇਮਨ੍ਟ ਜੀ ਆਫਲਾਈਨ ਵੀ ਹੋ ਜੇ ਗੀ ਨਹੀਂ ਡਿਸਕਾਉਂਟ ਕੋਈ ਨਹੀਂ ਹੈਗਾ ਜੀ ਹਾਂਜੀ ਆਨਲਾਈਨ ਤੁਹਾਡੇ ਸਮਾਨ ਦੇ ਹਿਸਾਬ ਨਾਲ ਹੋ ਗਏ ਜੀ ਜਿੱਦਾਂ ਤੁਹਾਡਾ ਸਮਾਨ ਹੋਊਗਾ ਜੇ ਜਿਆਦਾ ਸਮਾਨ ਹੋਊਗਾ ਉਸ ਹਿਸਾਬ ਨਾਲ ਹੋ ਸਕਦਾ ਥੋੜਾ ਘੱਟ ਵੱਧ ਕੀਤਾ ਜਾਊਗਾ ਫਿਲਹਾਲ ਤਾਂ ਨਹੀਂ ਲੱਗਿਆ ਵੀ ਲਗਾ ਦੇ ਕੋਈ ਆਫ਼ਰ ਹਾਂਜੀ ਕੋਈ ਗੱਲ ਨਹੀ ਜਦੋ ਮਰਜੀ ਆ ਜੋ

ਸੁਬਹ ਨੌ ਵਜੇ ਖੋਲ ਲੈਂਦੇ ਜੀ ਸ਼ਾਮੀ ਨੌ ਦਸ ਦਸ ਵਜੇ ਤੱਕ ਖੁਲੀ ਹੁੰਦੀ

ਠੀਕ ਹੈ ਜੀ